ਖੇਡਾਂ ਖੇਡਣ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ ਬਹੁਤ ਵੱਧਦਾ ਹੈ ਅਤੇ ਸ਼ਾਮ ਨੂੰ ਬੱਚੇ ਗਰਾਊਂਡ ਵਿੱਚ ਜਾਂਦੇ ਹਨ ਇਸ ਨਾਲ ਨਸ਼ਿਆਂ ਤੋਂ ਬਚਦੇ ਰਹਿੰਦੇ ਹਨ